ਪੰਜਾਬੀ ਪੰਜਾਬੀਆਂ ਦੀ ਲੋਕਪ੍ਰਿਯ ਭਾਸ਼ਾ ਹੈ ਕਿਸੇ ਵੀ ਟਾਈਮ 'ਤੇ ਪੰਜਾਬੀ ਪੰਜਾਬੀ ਨੂੰ ਬੋਲਣ 'ਤੇ ਬੜਾ ਹੀ ਮਾਣ ਮਹਿਸੂਸ ਕਰਦੇ ਹੁੰਦੇ ਸੀ ਪਰ ਅੱਜ ਕੱਲ੍ਹ ਪੰਜਾਬੀ ਨੂੰ ਬੋਲਣ ਅਤੇ ਪੰਜਾਬੀ ਲੋਕ ਆਪਣੀ ਭਾਸ਼ਾ ਨਾਲ ਅਨਪੜ੍ਹ ਮਹਿਸੂਸ ਕਰਦੇ ਹਨ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਅਗਰ ਅਸੀਂ ਕਿਤੇ ਵੀ ਜਾ ਕੇ ਪੰਜਾਬੀ ਬੋਲਾਂਗੇ ਤਾਂ ਜਾਂ ਪੰਜਾਬੀ ਵਿੱਚ ਗੱਲ ਕਰਾਂਗੇ ਤਾਂ ਸਾਨੂੰ ਇੱਦਾਂ ਲੱਗੇਗਾ ਕਿ ਲੋਕ ਸਾਨੂੰ ਅਨਪੜ੍ਹ ਸਮਝਣਗੇ ਅਤੇ ਇਸ ਕਰਕੇ ਅਸੀਂ ਅੱਜ ਕੱਲ੍ਹ ਆਪਣੀ ਪੰਜਾਬੀ ਨੂੰ ਭੁੱਲਦੇ ਜਾ ਰਹੇ ਹਾਂ ਜੋ ਕਿ ਬਹੁਤ ਮਾੜੀ ਗੱਲ ਹੈ ਸਾਨੂੰ ਆਪਣੇ ਪੰਜਾਬੀ ਭਾਸ਼ਾ ਨੂੰ ਸਾਂਭ ਸੰਭਾਲ ਕੇ ਰੱਖਣਾ ਚਾਹੀਦਾ ਇਹ ਸਾਡੇ ਵਿਰਸੇ ਅਤੇ ਸੱਭਿਆਚਾਰ ਦੀ ਇੱਕ ਮਹੱਤਵਪੂਰਨ ਨਿਸ਼ਾਨੀ ਹੈ ਸਾਨੂੰ ਆਪਣੇ ਪੰਜਾਬੀ ਨੂੰ ਵਧਾਵਾ ਦੇਣਾ ਆਪਣੇ ਘਰ ਤੋਂ ਹੀ ਸ਼ੁਰੂ ਕਰਨਾ ਪਵੇਗਾ ਅਸੀਂ ਘਰ ਵਿੱਚ ਹੀ ਆਪਣੇ ਬੱਚਿਆਂ ਨੂੰ ਪੰਜਾਬੀ ਨੂੰ ਵਧੀਆ ਢੰਗ ਨਾਲ ਬੋਲਣ ਲਈ ਬੋਲਣਾ ਚਾਹੀਦਾ ਹੈ ਅਤੇ ਵਧੀਆ ਢੰਗ ਨਾਲ ਬੋਲਣ ਲਈ ਉਹਨਾਂ ਨੂੰ ਪੁਰਾਣੇ ਸ਼ਬਦਾਂ ਬਾਰੇ ਦੱਸਣਾ ਚਾਹੀਦਾ ਹੈ ਜੋ ਕਿ ਅਸੀਂ ਅੱਜ ਕੱਲ੍ਹ ਬਿਲਕੁਲ ਵੀ ਨਹੀਂ ਕਰਦੇ ਅਸੀਂ ਉਹਨਾਂ ਨੂੰ ਅੰਗਰੇਜ਼ੀ ਵੱਲ ਹੀ ਧੱਕਦੇ ਆ ਰਹੇ ਹਾਂ ਕਿ ਹਰ ਵੇਲੇ ਅੰਗਰੇਜ਼ੀ ਬੋਲੋ ਹ ਘਰ ਵਿੱਚ ਵੀ ਬਹੁਤ ਜ਼ਿਆਦਾ ਅੰਗਰੇਜ਼ੀ ਯੂਜ ਕਰਦੇ ਹਾਂ ਅਸੀਂ ਸਾਨੂੰ ਪੰਜਾਬੀ ਨੂੰ ਵਧਾਵਾ ਦੇਣ ਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਕਰਨੀ ਪਵੇਗੀ ਅਤੇ ਉਸ ਤੋਂ ਅੱਗੇ ਹੋਰ ਪੰਜਾਬੀ ਨੂੰ ਨੈਸ਼ਨਲ ਲੈਵਲ ਦੇ ਸੈਮੀਨਾਰ ਕਰਕੇ ਵੀ ਅੱਗੇ ਵਧਾਇਆ ਜਾ ਸਕਦਾ ਹੈ ਅਤੇ ਹੋਰ ਕਈ ਤਰ੍ਹਾਂ ਦੇ ਛੋਟੇ ਮੋਟੇ ਕੋਰਸ ਦੁਆਰਾ ਵੀ ਬੱਚਿਆਂ ਨੂੰ ਪੰਜਾਬੀ ਬਾਰੇ ਦੱਸਿਆ ਜਾ ਸਕਦਾ ਹੈ ਅਤੇ ਇਸ ਦੇ ਬਾਰੇ ਅਗਰ ਹੋਰ ਕਿਸੇ ਨੂੰ ਦੇ ਵਿੱਚ ਵੀ ਦਿਲਚਸਪੀ ਦਾ ਪੈਦਾ ਕਰਨੀ ਹੋਵੇ ਅਤੇ ਇਸ ਬਾਰੇ ਹੋਰ ਦਿਲਚਸਪੀ ਪੈਦਾ ਕਰਨੇ ਹੋਵੇ ਤਾਂ ਅਸੀਂ ਪੰਜਾਬ ਪੰਜਾਬੀ ਬਾਰੇ ਇਹਨਾਂ ਦੇ ਪੰਜਾਬ ਦੇ ਇਤਿਹਾਸ ਬਾਰੇ ਦੱਸ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕਿੰਨੇ ਕਿੰਨੇ ਵੱਡੇ ਸੂਰਮੇ ਸਨ ਜੋ ਕਿ ਪੰਜਾਬੀ ਵਿੱਚ ਹੀ ਬੋਲਦੇ ਸਨ ਕਿ ਅਸੀਂ ਪੰਜਾਬ ਸਾਨੂੰ ਪੰਜਾਬੀ ਬੋਲਣ 'ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ